ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਪ੍ਰੀਤ ਹੈ ਮੈਂ ਓਡਰ ਨੰਬਰ ਛਿਵੰਜਾ ਤੋਂ ਬੋਲ ਰਹੀ ਹਾਂ ਮੈਂ ਤੁਹਾਨੂੰ ਪਹਿਲਾਂ ਓਡਰ ਦਿੱਤਾ ਸੀ ਜਿਸ ਵਿੱਚ ਚਪਾਤੀਆਂ ਦੀ ਗਿਣਤੀ ਇੱਕ ਅਤੇ ਨਾਨ ਦੀ ਗਿਣਤੀ ਦੋ ਸੀ ਹੁਣ ਸਾਡੇ ਘਰ ਮਹਿਮਾਨਾਂ ਦੀ ਗਿਣਤੀ ਵਧਣ ਕਰਕੇ ਮੈਂ ਓਡਰ ਵਿੱਚ ਕੁਝ ਤਬਦੀਲੀ ਕਰਨਾ ਚਾਹੁੰਦੀ ਹਾਂ ਜਿਵੇਂ ਕਿ ਹੁਣ ਇੱਕ ਚਪਾਤੀ ਦੀ ਬਜਾਏ ਮੈਨੂੰ ਤਿੰਨ ਚਪਾਤੀਆਂ ਚਾਹੀਦੀਆਂ ਹਨ ਅਤੇ ਦੋ ਨਾਨ ਦੀ ਬਜਾਏ ਪੰਜ ਨਾਨ ਚਾਹੀਦੇ ਹਨ ਕਿਰਪਾ ਕਰਕੇ ਮੇਰੇ ਓਡਰ ਵਿੱਚ ਤਬਦੀਲੀ ਕਰਕੇ ਮੈਨੂੰ ਮੇਰਾ ਓਡਰ ਜਲਦੀ ਤੋਂ ਜਲਦੀ ਭੇਜਣ ਦੀ ਕਿਰਪਾਲਤਾ ਕਰਨੀ ਧੰਨਵਾਦ